ਮੇਰੇ ਪੰਜਾਬੀ ਦੇ ਮਨਪਸੰਦ ਜਿਹੜੇ ਲੇਖਿਕਾ ਨੇ ਲੇਖਕ ਨੇ ਲੇਖਿਕਾ ਨੇ ਡਾਕਟਰ ਦਲੀਪ ਕੌਰ ਟਿਵਾਣਾ ਜੋ ਮੈਨੂੰ ਬਹੁਤ ਹੀ ਪਸੰਦ ਹਨ ਔਰ ਜ਼ਿਆਦਾਤਰ ਉਹਨਾਂ ਨੂੰ ਲੋਕ ਇੱਕ ਚੰਗੇ ਨੌਵਲਕਾਰ ਦੇ ਰੂਪ ਦੇ ਵਿੱਚ ਜਾਣਦੇ ਨੇ ਔਰ ਜਿਹੜੇ ਇਹ ਲੇਖਕ ਨੇ ਇਹਨਾਂ ਨੇ ਬਹੁਤ ਸਾਰੇ ਜਿਹੜੇ ਨੌਵਲ ਨੇ ਉਹ ਲਿਖੇ ਨੇ ਉਹਦੇ ਵਿੱਚ ਇਹਨਾਂ ਨੇ ਪੰਜ ਪੰਜ ਨੌਵਲਾਂ ਦੀਆਂ ਪੰਜ ਸੈਂਚੀਆਂ ਜਿਹੜੀਆਂ ਨੇ ਉਹ ਲਿਖੀਆਂ ਨੇ ਔਰ ਹਰ ਇੱਕ ਸੈਂਚੀ ਦੇ ਵਿੱਚ ਜਿਹੜੇ ਪੰਜ ਨੌਵਲ ਨੇ ਉਹ ਔਰਤ ਦੀ ਜ਼ਿੰਦਗੀ ਦੀ ਪੇਸ਼ਕਾਰੀ ਬਖੂਬੀ ਕਰਦੇ ਨੇ ਮੈਂ ਦਲੀਪ ਕੌਰ ਟਿਵਾਣਾ ਦੇ ਇਹ ਜਿਹੜੇ ਪੰਜ ਸੈਂਚੀਆਂ ਦੇ ਜਿਹੜੇ ਪੰਜੇ ਨੌਵਲ ਨੇ ਇਹ ਪੜ੍ਹੇ ਹੋਏ ਨੇ ਔਰ ਮੈਨੂੰ ਦਲੀਪ ਕੌਰ ਟਿਵਾਣਾ ਆਪਣੇ ਤਹਿ ਦਿਲੋਂ ਜਿਹੜੀ ਬਹੁਤ ਜ਼ਿਆਦਾ ਪਸੰਦ ਨੇ ਆਪਣੇ ਨੌਵਲਾਂ ਦੇ ਵਿੱਚ ਇਹਨਾਂ ਨੇ ਔਰਤ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਬੜੀ ਬਰੀਕੀ ਦੇ ਨਾਲ ਪੇਸ਼ ਕੀਤਾ ਹੈ ਔਰ ਬੜੀ ਤਸ਼ੱਦਦ ਦੇ ਨਾਲ ਉਹ ਜੋ ਮਰਦ ਵੱਲੋਂ ਦਿੱਤੇ ਜਾਂਦੇ ਜਿਹੜੇ ਦੁੱਖ ਨੇ ਜਿਹੜੇ ਸੰਤਾਪ ਨੇ ਜਿਹੜੀਆਂ ਖਾਹਿਸ਼ਾਂ ਨੇ ਜਿੰਨ੍ਹਾਂ ਨੂੰ ਦਬਾ ਕੇ ਉਹਨੂੰ ਸਾਰੀ ਉਮਰ ਰਹਿਣਾ ਪੈਂਦਾ ਹੈ ਉਹਨਾਂ ਸਾਰਿਆਂ ਨੂੰ ਬੜੀ ਵਧੀਆ ਤਰ੍ਹਾਂ ਬਖੂਬੀ ਉਹਨਾਂ ਨੇ ਆਪਣੇ ਨੌਵਲਾਂ ਦੇ ਵਿੱਚ ਪੇਸ਼ ਕੀਤਾ ਹੈ ਔਰ ਜਦੋਂ ਮੈਂ ਬੀ ਏ ਫਾਈਨਲ ਯੀਅਰ ਵਿੱਚ ਪੜ੍ਹਦੀ ਸੀ ਤਾਂ ਲਾਈਬਰੇਰੀ ਦੇ ਵਿੱਚ ਜਾ ਕੇ ਥੋੜ੍ਹਾ ਸਮਾਂ ਕੱਢ ਕੇ ਮੈਂ ਇਸ ਨਾਵਲਕਾਰ ਦੇ ਜਿਹੜੇ ਨਾਵਲ ਨੇ ਪੜ੍ਹ ਪੜ੍ਹ ਕੇ ਪੂਰੇ ਕਰਦੀ ਸੀ ਇੱਕ ਇੱਕ ਮਹੀਨੇ ਲਈ ਮੈਂ ਇਹਨਾਂ ਦੀਆਂ ਜਿਹੜੀਆਂ ਸੈਂਚੀਆਂ ਨੇ ਉਹ ਲਾਈਬਰੇਰੀ ਤੋਂ ਲੈ ਕੇ ਆਉਂਦੀ ਸੀ ਫਿਰ ਉਹਨਾਂ ਨੂੰ ਦਿਨ ਰਾਤ ਜਿਹੜਾ ਹੈ ਉਹ ਪੜ੍ਹਦੀ ਰਹਿੰਦੀ ਸੀ ਕਈ ਵਾਰ ਤਾਂ ਇਸਦੇ ਨਾਵਲ ਪੜ੍ਹ ਪੜ੍ਹ ਕੇ ਮੈਂ ਕਿੰਨੇ ਕਿੰਨੇ ਦਿਨ ਇਸ ਸੋਚਦੀ ਰਹਿੰਦੀ ਸੀ ਕਿ ਇੰਨੇ ਜ਼ਿਆਦਾ ਦੁੱਖ ਵੀ ਇੱਕ ਔਰਤ ਦੀ ਜ਼ਿੰਦਗੀ ਦੇ ਵਿੱਚ ਹੋ ਸਕਦੇ ਨੇ ਅਤੇ ਦੂਸਰਾ ਮੈਨੂੰ ਇਹ ਚੀਜ਼ ਸੋਚਣ ਲਈ ਮਜ਼ਬੂਰ ਕਰ ਦਿੰਦੀ ਸੀ ਕਿ ਕੀ ਔਰਤ ਇਹਨਾਂ ਨੂੰ ਦੁੱਖਾਂ ਨੂੰ ਸਹਿ ਸਹਿ ਕੇ ਥੱਕਦੀ ਨਹੀਂ ਹਿੰਮਤ ਨਹੀਂ ਹਾਰਦੀ ਦਲੀਪ ਕੌਰ ਟਿਵਾਣਾ ਦੇ ਨੌਵਲ ਔਰਤ ਨੂੰ ਉਹਨਾਂ ਤੰਗੀਆਂ ਉਹਨਾਂ ਤੁਰਸ਼ੀਆਂ ਦੇ ਵਿੱਚੋਂ ਕੱਢ ਕੇ ਇੱਕ ਨਵੀਂ ਜਿੰਦਗੀ ਜੀਵਨ ਜਾਂਚ ਜਿਹੜੀ ਹੈ ਉਹ ਜੀਣਾ ਸਿਖਾਉਂਦੇ ਨੇ ਦਲੀਪ ਕੌਰ ਟਿਵਾਣਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀ ਦੋ ਚਾਰ ਸਾਲ ਹੋ ਗਏ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਉਹ ਮੇਰੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਨੇ ਮੈਨੂੰ ਬਹੁਤ ਦੁੱਖ ਹੋਇਆ ਬਹੁਤ ਦਿਨ ਕਾਫ਼ੀ ਸਦਮੇ ਦੇ ਵਿੱਚ ਰਹੀ ਜਦੋਂ ਮੈਨੂੰ ਇਹ ਪਤਾ ਚੱਲਿਆ ਕਿ ਉਹ ਇਸ ਦੁਨੀਆਂ ਤੋਂ ਜਾ ਚੁੱਕੇ ਨੇ ਪਰ ਆਪਣੀਆਂ ਰਚਨਾਵਾਂ ਦੇ ਜ਼ਰੀਏ ਔਰ ਆਪਣੇ ਜਿਹੜੇ ਲਿਖਤ ਹੈ ਜਿਹੜੀ ਉਹਨਾਂ ਨੇ ਇੱਕ ਬਹੁਮੁੱਲਾ ਖਜ਼ਾਨਾ ਲੋਕਾਂ ਨੂੰ ਦਿੱਤਾ ਹੈ ਉਹਦੇ ਜ਼ਰੀਏ ਉਹ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਵਿੱਚ ਵੀ ਜ਼ਿੰਦਾ ਰਹਿਣਗੇ ਔਰ ਮੇਰੇ ਦਿਲ ਵਿੱਚ ਉਹਨਾਂ ਦਾ ਇੱਕ ਅਹਿਮ ਸਥਾਨ ਹੈ ਜਿਸ ਸਥਾਨ ਨੂੰ ਮੈਂ ਸ਼ਾਇਦ ਕਦੇ ਕਿਸੇ ਹੋਰ ਨੌਵਲਕਾਰ ਜਾਂ ਲੇਖਕ ਨੂੰ ਨਹੀਂ ਦੇ ਸਕਦੀ ਦਲੀਪ ਕੌਰ ਟਿਵਾਣਾ ਔਰਤਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਸਾਰੀਆਂ ਹੀ ਔਰਤਾਂ ਨੂੰ ਉਹਨਾਂ ਦੀ ਇਹ ਨੌਵਲ ਪੜ੍ਹ ਕੇ ਆਪਣੀ ਜਿੰਦਗੀ ਵਿੱਚ ਉਹਨਾਂ ਦੇ ਨੌਵਲਾਂ ਤੋਂ ਕੋਈ ਨਾ ਕੋਈ ਜਿਹੜੀ ਪ੍ਰੇਰਨਾ ਹੈ ਉਹ ਲੈਣੀ ਚਾਹੀਦੀ ਹੈ ਕਿਉਂਕਿ ਔਰਤ ਨੂੰ ਇੱਕ ਨਵੇਂ ਰੂਪ 'ਚ ਪੇਸ਼ ਕੀਤਾ ਉਹਨਾਂ ਦੂਸਰਾ ਔਰਤ ਨੇ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਨੂੰ ਕਿਵੇਂ ਨਿਪਟਾਉਣਾ ਹੈ ਉਹਨਾਂ ਚੋਂ ਕਿਵੇਂ ਬਾਹਰ ਆਉਣਾ ਹੈ ਔਰ ਆਪਣੀ ਜਿੰਦਗੀ ਨੂੰ ਕਿਵੇਂ ਇੱਕ ਜਿਹੜੀ ਨਵੀਂ ਸੇਧ ਦੇਣੀ ਹੈ ਉਹਦੇ ਬਾਰੇ ਉਹਨਾਂ ਨੇ ਦੱਸਿਆ